ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਹੈ ਜੀ ਬਸ ਠੀਕ ਹੈ ਜੀ ਮੈਂ ਤੁਹਾਨੂੰ ਕੁਛ ਮੂਵੀਜ਼ ਬਾਰੇ ਪੁੱਛਣਾ ਸੀਗਾ ਹਾਂਜੀ ਐਕਚੁਲੀ ਮੈਂ ਨਾ ਪਹਿਲੇ ਹੋਲੀਵੁੱਡ ਮੂਵੀਜ਼ ਜ਼ਿਆਦਾ ਦੇਖਦੀ ਹੁੰਦੀ ਸੀਗੀ ਅਤੇ ਹੁਣ ਮੇਰਾ ਥੋੜ੍ਹਾ ਜਿਹਾ ਮਨ ਕੀਤਾ ਹੈ ਕਿ ਮੈਂ ਥੋੜ੍ਹੀ ਬੋਲੀਵੁੱਡ ਮੂਵੀਜ਼ ਵੀ ਦੇਖਾਂ ਕਿ ਮੈਨੂੰ ਪਸੰਦ ਆਉਂਦੀਆਂ ਕਿ ਨਹੀਂ ਮੇਰਾ ਕਿੱਦਾਂ ਦਾ ਟੇਸਟ ਹੈਗਾ ਹੈ ਅਤੇ ਜੇ ਮੈਨੂੰ ਪਤਾ ਲੱਗਿਆ ਤੁਹਾਨੂੰ ਕਾਫੀ ਪਸੰਦ ਨੇ ਤੁਸੀਂ ਦੇਖਦੇ ਰਹਿੰਦੇ ਹੋ ਬੋਲੀਵੁੱਡ ਮੂਵੀਜ਼ ਅਤੇ ਤੁਸੀਂ ਮੈਨੂੰ ਉਹਨਾਂ ਦਾ ਕੁਛ ਨਾਮ ਵਗੈਰਾ ਸੁਜੈਸਟ ਕਰ ਸਕਦੇ ਹੋ ਬਸ ਅੱਛੀਆਂ ਹੋਣ ਜਿਹੜੀ ਦੇਖਣ ਦੇ ਵਿੱਚ ਜਿਹੜੀ ਅੱਛੀ ਲੱਗਣ ਨਹੀਂ ਨਹੀਂ ਸਿਰਫ ਬੋਲੀਵੁੱਡ ਹੀ ਚਾਹੀਦੀਆਂ ਮੈਨੂੰ ਅਤੇ ਜੇ ਤੁਹਾਡੇ ਕੋਲ ਕੁਝ ਅੱਛੀ ਮੂਵੀਜ਼ ਹੈਗੀਆਂ ਤਾਂ ਤੁਸੀਂ ਮੈਨੂੰ ਉਹਨਾਂ ਦਾ ਵਟਸਐਪ ਲਿੰਕ ਕਰ ਦਿਓ ਅਤੇ ਮੈਂ ਦੇਖ ਲਵਾਂਗੀ ਉਹਨਾਂ ਨੂੰ ਹਾਂਜੀ ਅੱਛਾ ਅੱਛਾ ਜੀ ਅੱਛਾ ਜੀ ਅਤੇ ਕਿਹੜੇ ਕਿਹੜੇ ਮੇਨ ਐਕਟਰਸ ਔਰ ਐਕਟਰਸਿਸ ਹੈਗੀਆਂ ਨੇ ਜਿਹੜੇ ਅੱਜ ਕੱਲ੍ਹ ਬਹੁਤ ਜ਼ਿਆਦਾ ਫੇਮਸ ਨੇ ਹਾਂਜੀ ਹੀ ਹਾਂਜੀ ਜਿਹੜੀ ਵੀ ਤੁਹਾਨੂੰ ਠੀਕ ਲੱਗਦੀਆਂ ਨੇ ਤੁਹਾਨੂੰ ਜਿਹੜੀਆਂ ਅੱਛੀਆਂ ਲੱਗਦੀਆਂ ਹੈ ਵੀ ਮੈਂ ਦੇਖਾਂ ਮੈਨੂੰ ਅੱਛੀ ਲੱਗਣ ਬਸ ਤੁਸੀਂ ਮੈਨੂੰ ਉਹਨਾਂ ਦੇ ਲਿੰਕ ਸੈਂਡ ਕਰ ਦਿਓ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਓਕੇ ਜੀ ਬਾਏ